ਪਿੰਜਰੇ ਵਿੱਚ ਕੈਦ ਪੰਛੀਆਂ ਨੂੰ ਦੇਖ ਕੇ ਮੇਰੇ ਦਿਮਾਗ ਵਿੱਚ ਸਭ ਤੋਂ ਵੱਡੀ ਗੱਲ ਇਹੀ ਆਉਂਦੀ ਹੈ ਕਿ ਕੀ ਇਹਨਾਂ ਨੂੰ ਆਜ਼ਾਦੀ ਦਾ ਕੋਈ ਹੱਕ ਨਹੀਂ ਹੈਗਾ ਇਹ ਪੰਛੀ ਨੇ ਅਤੇ ਇਹਨਾਂ ਨੂੰ ਤੁਸੀਂ ਕੈਦ ਕਰ ਲਵੋਗੇ ਮੇਰਾ ਦਿਲ ਕੰਬ ਉੱਠਦਾ ਹੈ ਮੈਂ ਚਾਹੁੰਦੀ ਹਾਂ ਕਿ ਕੋਈ ਪੰਛੀ ਵੀ ਕੈਦ ਨਾ ਕੀਤਾ ਜਾਵੇ ਕਿਸੇ ਨੂੰ ਵੀ ਕੈਦ ਰੱਖਣ ਦਾ ਕੋਈ ਹੱਕ ਨਹੀਂ ਹੈਗਾ ਮੇਰਾ ਇੱਕ ਵਾਰੀ ਸਹੇਲੀ ਵੱਲ ਜਾਣ ਦਾ ਮੌਕਾ ਲੱਗਿਆ ਉਹਨਾਂ ਦੇ ਘਰ ਮੈਂ ਇੱਕ ਦੇਖਿਆ ਕਿ ਉਹਨਾਂ ਨੇ ਪਿੰਜਰੇ ਵਿੱਚ ਇੱਕ ਤੋਤਾ ਕੈਦ ਕਰਕੇ ਰੱਖਿਆ ਹੋਇਆ ਸੀ ਮੇਰਾ ਮਨ ਉਹਨਾਂ ਨੂੰ ਮਨਾਉਣ ਵਿੱਚ ਲੱਗ ਗਿਆ ਕਿ ਤੁਸੀਂ ਇਹਨੂੰ ਆਜ਼ਾਦ ਕਰ ਦੇਵੋ ਮੈਂ ਉਹਨਾਂ ਦੀ ਮਿੰਨਤ ਵੀ ਕੀਤੀ ਪਰ ਉਹ ਲੋਕ ਇੰਨੀ ਉਹਦੇ ਮੋਹ ਵਿੱਚ ਫਸੇ ਹੋਏ ਸੀਗੇ ਕਿ ਉਹਨਾਂ ਨੂੰ ਆਜ਼ਾਦ ਕਰਨ ਲਈ ਛੱਡਿਆ ਨਹੀਂ ਹਰ ਇਨਸਾਨ ਦਾ ਹੱਕ ਹੈ ਕਿ ਉਹ ਆਪਣੀ ਜ਼ਿੰਦਗੀ ਆਜ਼ਾਦੀ ਨਾਲ ਜੀਵੇ ਤਾਂ ਕਿ ਇੱਕ ਪੰਛੀ ਨੂੰ ਤੁਸੀਂ ਕੈਦ ਕਰਕੇ ਰੱਖ ਲੈਣਾ ਚਾਹੁੰਦੇ ਹੋ ਇਹ ਕਿਤਨਾ ਗਲਤ ਖਿਆਲ ਹੈ ਤੁਹਾਡਾ ਮੈਂ ਉਹਨਾਂ ਨੂੰ ਇਹ ਵੀ ਸਮਝਾਇਆ ਪਰ ਉਹ ਨਹੀਂ ਮੰਨੇ ਮੈਂ ਕਿਹਾ ਜੇ ਤੁਹਾਡੇ ਮਨ ਵਿਚ ਇਹਨਾਂ ਲਈ ਕੋਈ ਮਮਤਾ ਨਹੀਂ ਹੈਗੀ ਕਿ ਇਹਨਾਂ ਨੂੰ ਆਜ਼ਾਦ ਰਿਹਾ ਜਾਏ ਰੱਖਿਆ ਜਾਏ ਤਾਂ ਤੁਹਾਡੀ ਮਰਜ਼ੀ ਅਤੇ ਮੈਂ ਉਹਨਾਂ ਨਾਲ ਨਰਾਜ਼ ਹੋ ਕੇ ਆ ਗਈ ਕਿਉਂਕਿ ਮੈਂ ਆਪਣੀ ਇਹ ਗੱਲ ਉਹਨਾਂ ਨਾਲ ਪੂਰੀ ਨਹੀਂ ਕਰ ਪਾਈ